ਮੈਂ ਸਿਮਰਪ੍ਰੀਤ ਸਿੰਘ ਤਰਨ ਤਾਰਨ ਦਾ ਨਿਵਾਸੀ ਹਾਂ ਮੈਂ ਅੱਜ ਰਾਤ ਕਰੀਬ ਦਸ ਵਜੇ ਸਵੀ ਤੁਹਾਡੇ ਐਪਲੀਕੇਸ਼ਨ ਸਵਿਗੀ ਤੋਂ ਕੁਝ ਖਾਣ ਲਈ ਰੈਸਟੋਰੈਂਟ ਤੋਂ ਔਡਰ ਕੀਤਾ ਸੀ ਮੇਰੇ ਕੁਝ ਦੋਸਤ ਘਰ ਆਏ ਸਨ ਅਤੇ ਮੇਰਾ ਪਰਿਵਾਰ ਘਰ ਨਹੀਂ ਸੀ ਇਸ ਲਈ ਮੈਂ ਰਾਤ ਦਸ ਵਜੇ ਦੇ ਕਰੀਬ ਔਡਰ ਕੀਤਾ ਬਾਹਰ ਮੌਸਮ ਬਹੁਤ ਖ਼ਰਾਬ ਸੀ ਮੀਂਹ ਚ ਪੈ ਰਿਹਾ ਸੀ ਅਤੇ ਹਨੇਰੀ ਵੀ ਬਹੁਤ ਤੇਜ਼ ਚੱਲ ਰਹੀ ਸੀ ਮੈਂ ਆਪ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਜੋ ਮੈਨੂੰ ਦਸ ਵਜੇ ਤੋਂ ਬਾਅਦ ਵੀ ਔਡਰ ਡਿਲੀਵਰ ਕੀਤਾ ਭੋਜਨ ਬਹੁਤ ਹੀ ਸਵਾਦ ਸੀ ਇਸ ਲਈ ਮੈਂ ਜੋ ਡਿਲੀਵਰੀ ਪਾਰਟਨਰ ਨੂੰ ਪੰਜ ਸੌ ਰੁਪਏ ਟਿਪ ਦੇਣਾ ਚਾਹੁੰਦਾ ਹਾਂ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਕਿ ਤੁਸੀਂ ਪੰਜ ਸੌ ਰੁਪਏ ਟਿਪ ਇਹ ਡਿਲੀਵਰੀ ਬੋਆਏ ਨੂੰ ਦੇ ਦਿਓ ਅਤੇ ਤੁਹਾਡਾ ਰੈਸਟੋਰੈਂਟ ਵੀ ਬਹੁਤ ਵਧੀਆ ਸੀ ਮੈਂ ਕੈਫੇ ਇਟਾਲੀਆ ਤੋਂ ਔਡਰ ਕੀਤਾ ਸੀ ਭੋਜਨ ਬਹੁਤ ਸਵਾਦ ਸੀ ਪੈਕਜਿੰਗ ਵੀ ਬਹੁਤ ਵਧੀਆ ਸੀ ਮੈਂ ਔਡਰ ਤੋਂ ਬਹੁਤ ਖੁਸ਼ ਹੋਇਆ ਧੰਨਵਾਦ